ਭਾਰਤ ਵਿੱਚ ਬਹੁਤ ਸਾਰੇ ਮਹੱਤਵਪੂਰਨ ਸਥਾਨ ਹਨ ਜਿਹਨਾਂ ਵਿੱਚ ਸਾਡੇ ਪੰਜਾਬ ਦਾ ਸਭ ਤੋਂ ਮਹੱਤਵਪੂਰਨ ਸਥਾਨ ਅੰਮ੍ਰਿਤਸਰ ਮੰਨਿਆ ਜਾਂਦਾ ਹੈ ਅੰਮ੍ਰਿਤਸਰ ਪੰਜਾਬ ਦਾ ਇੱਕ ਮਹੱਤਵਪੂਰਨ ਜ਼ਿਲ੍ਹਾ ਹੈ ਅੰਮ੍ਰਿਤਸਰ ਦੇ ਵਿੱਚ ਸਾਡਾ ਗੁਰਦੁਆਰਾ ਸਾਹਿਬ ਗੁਰੂ ਰਾਮਦਾਸ ਗੁਰਦੁਆਰਾ ਸਾਹਿਬ ਜੋ ਕਿ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਗੁਰਦੁਆਰਾ ਸਾਹਿਬ ਬਹੁਤ ਹੀ ਆਕਰਸ਼ਕ ਗੁਰਦੁਆਰਾ ਹੈ ਜਿਸ ਨੂੰ ਲੋਕ ਬਾਹਰੋਂ ਵੀ ਦੂਰੋਂ ਦੂਰੋਂ ਦੇਖਣ ਆਉਂਦੇ ਹਨ ਫੋਰਨ ਕੰਟਰੀਆਂ ਵਿੱਚੋਂ ਵੀ ਲੋਕ ਗੁਰੂ ਸਾਹਿਬ ਗੁਰਦੁਆਰੇ ਵਿੱਚ ਦਰਸ਼ਨ ਕਰਨ ਆਉਂਦੇ ਹਨ ਗੁਰਦੁਆਰਾ ਸਾਹਿਬ ਦੇ ਦੇ ਵਿੱਚ ਇੱਕ ਬਹੁਤ ਵੱਡਾ ਸਰੋਵਰ ਹੈ ਬਹੁਤ ਵੱਡੀ ਬਿਲਡਿੰਗ ਹੈ ਬਹੁਤ ਵੱਡਾ ਗੁਰਦੁਆਰਾ ਬਹੁਤ ਹੀ ਆਕਰਸ਼ਕ ਦ੍ਰਿਸ਼ ਹੈ ਜਿੱਥੇ ਜਾ ਕੇ ਸਾਨੂੰ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਹੈ ਗੁਰੂ ਰਾਮਦਾਸ ਇੱਕ ਬਹੁਤ ਵੱਡਾ ਸਰੋਵਰ ਹੈ ਜਿਸ ਵਿੱਚ ਲੋਕ ਆਪਣਾ ਇਸ਼ਨਾਨ ਕਰਦੇ ਹਨ ਅਤੇ ਆਪਣੇ ਆਪਣੇ ਦਿਲ ਨੂੰ ਸਕੂਨ ਪੈਦਾ ਹੁੰਦਾ ਹੈ ਸ਼ਾਂਤੀ ਮਿਲਦੀ ਹੈ ਬਹੁਤ ਦੁਨੀਆ ਉੱਥੇ ਘੁੰਮਣ ਵਾਸਤੇ ਆਉਂਦੀ ਹੈ ਬਹੁਤ ਵੱਡਾ ਬਾਹਰ ਬਜ਼ਾਰ ਲੱਗਦਾ ਹੈ ਇੱਕ ਜਲਿਆਂਵਾਲਾ ਬਾਗ ਹੈ ਅੰਮ੍ਰਿਤਸਰ ਦੇ ਵਿੱਚ ਜਿਹਨੂੰ ਲੋਕ ਦੇਖਣ ਆਉਂਦੇ ਹਨ ਜਲਿਆਂਵਾਲਾ ਕਾਂਢ ਦੇ ਸਾਰੇ ਦ੍ਰਿਸ਼ ਉੱਥੇ ਦੇਖਣ ਨੂੰ ਮਿਲਦੇ ਹਨ ਦੂਸਰਾ ਭਾਰਤ ਦਾ ਸੈਲਾਨੀ ਆਕਰਸ਼ਕ ਦੇ ਆਕਰਸ਼ਕ ਦੇ ਹੈ ਇੱਕ ਦੇਸ਼ ਉਹ ਆਕਰਸ਼ਕ ਦ੍ਰਿਸ਼ ਉਹ ਹੈ ਸ਼ਿਮਲਾ ਸ਼ਿਮਲਾ ਇਕ ਸੈਲਾਨੀ ਆਕਰਸ਼ਕ ਦ੍ਰਿਸ਼ ਆਕਰਸ਼ਕ ਦੇਸ਼ ਹੈ ਸ਼ਿਮਲੇ ਦੇ ਵਿੱਚ ਬਹੁਤ ਹੀ ਹਰੇ ਬਈ ਹਰਿਆਲੀ ਹੈ ਜਿਸ ਵਿੱਚ ਬਹੁਤ ਹੀ ਜ਼ਿਆਦਾ ਹਰੇਵਾਈ ਹੋਣ ਦੇ ਕਾਰਨ ਆਕਸੀਜਨ ਕਾਫੀ ਮਾਤਰਾ ਵਿੱਚ ਸਾਨੂੰ ਮਿਲਦੀ ਹੈ ਸ਼ਿਮਲੇ ਵਿੱਚ ਜਾ ਕੇ ਸਾਨੂੰ ਬਹੁਤ ਹੀ ਵਧੀਆ ਫੀਲਿੰਗ ਆਉਂਦੀ ਹੈ ਬਹੁਤ ਹੀ ਠੰਢ ਮਹਿਸੂਸ ਹੁੰਦੀ ਹੈ ਸ਼ਿਮਲੇ ਜਾ ਕੇ ਗਰਮੀਆਂ ਦੇ ਵਿੱਚ ਆਮ ਤੌਰ 'ਤੇ ਲੋਕ ਸੈਲਾਨੀ ਆਕਰਸ਼ਕ ਦੇਸ਼ਾਂ ਵਿੱਚ ਪੰਜਾਬ ਦੇ ਇਲਾਕਿਆਂ ਵਿੱਚ ਘੁੰਮਣ ਜਾਂਦੇ ਹਨ ਜੋ ਕਿ ਇੱਕ ਇੱਕ ਮੇਨ ਇਲਾਕਾ ਹੈ ਸ਼ਿਮਲਾ ਉਸ ਦੇ ਨਾਲ ਹੀ ਇੱਕ ਕੁਫਰੀ ਹੈ ਕੁਫਰੀ ਦੇ ਵਿੱਚ ਵੀ ਬੜਾ ਹੀ ਬਹੁਤ ਹੀ ਸੁੰਦਰ ਦ੍ਰਿਸ਼ ਹਨ ਜੋ ਕਿ ਦੇਖਣ ਵਿੱਚ ਬਹੁਤ ਹੀ ਸੁੰਦਰ ਅਤੇ ਦਿਲ ਨੂੰ ਸਕੂਨ ਦਿੰਦੇ ਹਨ